ਅਸੀਂ ਛੋਟੇ ਹੁੰਦੇ ਸਮੇਂ ਬਹੁਤ ਤਰ੍ਹਾਂ ਦੀਆਂ ਮੂਰਤੀਆਂ ਬਣਾਉਂਦੇ ਹੁੰਦੇ ਸੀ ਜਿਵੇਂ ਤਿਉਹਾਰਾਂ 'ਤੇ ਸਾਂਝੀ ਦੀ ਮੂਰਤੀ ਬਣਾਉਣਾ ਗਾਰਾ ਲਿੱਪ ਕੇ ਉਹਨੂੰ ਦਵਾਰ 'ਤੇ ਲਾਉਣਾ ਉਹ ਤੇ ਬਾਅਦ ਨੌ ਦਿਨ ਬਾਅਦ ਉਹਨੂੰ ਪਾਣੀ ਤੇ ਬਹਾਉਣਾ ਉਹ ਤੋਂ ਉਸ ਤੋਂ ਬਾਅਦ ਰਾਵਣ ਦੀ ਮੂਰਤੀ ਬਣਾਉਣਾ ਇਹ ਜਣੋ ਵੀ ਵਧੀਆ ਸਾਨੂੰ ਅਨੁਭਵ ਹੁੰਦਾ ਸੀ ਚਾਅ ਚੜ੍ਹਦਾ ਸੀ ਵੀ ਅਸੀਂ ਆਪਣੇ ਦੇਵਤਿਆਂ ਨੂੰ ਪੂਜ ਰਹੇ ਹਾਂ ਵੀ ਉਹਨਾਂ ਤੋਂ ਸਿੱਖਿਆ ਲੈ ਰਹੇ ਹਾਂ ਵੀ ਕਿ ਕਿਵੇਂ ਸਾਡਾ ਸੱਭਿਆਚਾਰ ਚੱਲਦਾ ਆਉਂਦਾ ਹੈ ਕਿਵੇਂ ਨੇ ਬੁਰਾਈ 'ਤੇ ਅੱਛਾਈ ਦੀ ਜਿੱਤ ਹੁੰਦੀ ਰਹੀ ਹੈ ਇਸ ਲਈ ਸਾਨੂੰ ਇਹਨਾਂ ਇਹਨਾਂ ਚੀਜ਼ਾਂ ਦਾ ਅਨੁਭਵ ਮਿਲਦਾ ਸੀ